ਮੇਰਾ ਮਨਪਸੰਦ ਪੰਜਾਬੀ ਲੇਖਕ ਅਜਮੇਰ ਸਿੰਘ ਜੀ ਹਨ ਜ ਜੋ ਕਿ ਪੰਜਾਬ ਬਾਰੇ ਬਹੁਤ ਹੀ ਸੋਹਣਾ ਲਿਖਦੇ ਹਨ ਉਹਨਾਂ ਦੀਆਂ ਹਰ ਕਿਤਾਬਾਂ ਮੈਂ ਤਕਰੀਬਨ ਪੜ੍ਹੀਆਂ ਹਨ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਜੋ ਵੀ ਨਵੀਂ ਆਉਂਦੀ ਹੈ ਅਤੇ ਮੈਨੂੰ ਉਹਦੇ 'ਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿ ਉਹ ਸਮਾਜ ਬਾਰੇ ਆਪਣੇ ਲੋਕਾਂ ਬਾਰੇ ਅਤੇ ਦੇਸ਼ ਵਿੱਚ ਕੀ ਹੋ ਰਿਹਾ ਚੰਗਾ ਮੰਦਾ ਉਹਨਾਂ ਬਾਰੇ ਜਾਣਕਾਰੀ ਦਿੰਦੇ ਹਨ ਅਤੇ ਉਹਨਾਂ ਦਾ ਇਕੱਲਾ ਇਕੱਲਾ ਲੇਖ ਜਾਂ ਮੈਨੂੰ ਬਹੁਤ ਹੀ ਸ਼ਬਦਾਵਲੀ ਬਹੁਤ ਵਧੀਆ ਲੱਗਦੀ ਹੈ ਅਤੇ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਅਤੇ ਹਰ ਇੱਕ ਬੰਦਾ ਜਾਂ ਚਾਰ ਚਾਰ ਸਾਰਾ ਕੁਛ ਲਈ ਠੀਕ ਕਰਦਾ ਉਹਨਾਂ ਦੀ ਇੱਕ ਕਿਤਾਬ ਸ਼ਹੀਦ ਕਰਤਾਰ ਸਿੰਘ ਸਰਾਭਾ ਜੋ ਕਿ ਮੈਂ ਪੜ੍ਹੀ ਹੈ ਅਤੇ ਉਹ ਮੈਨੂੰ ਬਹੁਤ ਹੀ ਵਧੀਆ ਲੱਗੀ ਜਿਸ ਵਿੱਚ ਉਹਨਾਂ ਨੇ ਆਜ਼ਾਦੀ ਘੁਟਾਲਿਆਂ ਬਾਰੇ ਦੱਸਿਆ ਗਿਆ ਹੈ ਕਿ ਕਿਵੇਂ ਕਰਤਾਰ ਸਿੰਘ ਸਰਾਭਾ ਜੋ ਕਿ ਛੋਟੀ ਉਮਰ ਵਿੱਚ ਹੀ ਸ਼ਹੀਦ ਹੋ ਗਏ ਸੀ ਉਹਨਾਂ ਨੇ ਕਿਵੇਂ ਕਿੰਨੀ ਦਲੇਰੀ ਸੀ ਉਹਨਾਂ ਵਿੱਚ ਅਤੇ ਕਿੰਨਾ ਜਜ਼ਬਾ ਸੀ ਗਦਰ ਪਾਰਟੀ ਸਾਰੇ ਪੰਜਾਬੀਆਂ ਅਤੇ ਹੋਰ ਦੇਸ਼ ਦੇ ਜਿੰਨੇ ਵੀ ਦੇਸ਼ ਭਗਤ ਸੀ ਉਹਨਾਂ ਨਾਲ ਰਲ ਕੇ ਕੰਮ ਕੀਤਾ ਅਤੇ ਉਹ ਮੈਨੂੰ ਬਹੁਤ ਹੀ ਵਧੀਆ ਲੱਗਿਆ ਅਤੇ ਮੈਨੂੰ ਬਹੁਤ ਹੀ ਇੱਕ ਇਸ ਬਾਰੇ ਚਾਨਣਾ ਪਿਆ ਕਿ ਉਹ ਇੰਨੀ ਛੋਟੀ ਉਮਰ ਵਿੱਚ ਇਨ ਇੰਨੀਆਂ ਉਪਲਬਧੀਆਂ ਕਰ ਗਏ ਸਾਡਾ ਵੀ ਮਨ ਕਰਦਾ ਕਿ ਅਸੀਂ ਤਾਂ ਦੇਸ਼ ਲਈ ਕੁਛ ਨਾ ਕੁਛ ਕਰ ਸਕੀਏ